ਮੈ ਰੋਜ਼ਾਨਾ ਸਵੇਰੇ ਛੇ ਵਜੇ ਉੱਠ ਕੇ ਰਨਿੰਗ ਲਈ ਜਾਂਦੀ ਹਾਂ ਅਤੇ ਅੱਧਾ ਘੰਟਾ ਹਰ ਰੋਜ਼ ਰਨਿੰਗ ਜ਼ਰੂਰ ਕਰਦੀ ਹਾਂ ਰਨਿੰਗ ਕਰਨ ਤੋਂ ਬਾਅਦ ਸਾਨੂੰ ਪਸੀਨਾ ਆਉਂਦਾ ਤਾਂ ਉਹ ਕਈ ਬਿਮਾਰੀਆਂ ਤੋਂ ਬਚਾਉਂਦਾ ਮੈਂ ਪਹਿਲਾਂ ਕਾਫੀ ਜ਼ਿਆਦਾ ਬਿਮਾਰ ਰਹਿੰਦੀ ਸੀ ਪਰ ਜਦੋਂ ਤੋਂ ਮੈਂ ਰਨਿੰਗ ਸ਼ੁਰੂ ਕੀਤੀ ਆ ਉਦੋਂ ਤੋਂ ਮੈਂ ਤੰਦਰੁਸਤ ਸ਼ੁ ਰਹਿਣਾ ਸ਼ੁਰੂ ਹੋ ਗਈ ਆਂਗੀ ਮੇਰਾ ਪਹਿਲਾਂ ਕਾਫੀ ਜ਼ਿਆਦਾ ਸਾਹ ਚੜਦਾ ਸੀਗਾ ਅਤੇ ਪਰ ਜਦੋਂ ਮੈਂ ਰਨਿੰਗ ਕਰ ਰਹੀ ਹਾਂ ਉਦੋਂ ਤੋਂ ਮੇਰਾ ਸਾਹ ਚੜਨਾ ਬੰਦ ਹੋ ਗਿਆ ਗਾ ਅਤੇ ਜਿਹੜੀ ਮੇਰੀ ਅਮਿਊਨਿਟੀ ਆ ਉਹ ਵੀ ਕਾਫੀ ਜ਼ਿਆਦਾ ਵਧੀ ਆ ਅਤੇ ਹੁਣ ਮੈਂ ਸ਼ਾਮ ਨੂੰ ਵੀ ਰਨਿੰਗ ਸ਼ੁਰੂ ਕੀਤੀ ਆਗੀ ਅਤੇ ਸ਼ਾਮ ਨੂੰ ਵੀ ਅੱਧਾ ਘੰਟਾ ਰਨਿੰਗ ਲਈ ਜ਼ਰੂਰ ਜਾਂਦੀ ਹਾਂ ਅਤੇ ਇਹਦੇ ਨਾਲ ਜਿਹੜਾ ਸਾਡਾ ਸਟੈਮਿਨਾ ਉਹ ਵੀ ਸਟਰੋਂਗ ਹੁੰਦਾ ਗਾ ਅਤੇ ਦੂਸਰਾ ਜਿਹੜੀ ਸਾਡਾ ਚਿਹਰਾ ਗਾ ਉਹਦੇ 'ਤੇ ਵੀ ਰੌਣਕ ਆਉਂਦੀ ਆ ਅਤੇ ਰਨਿੰਗ ਸ਼ੁਰੂ ਕਰਨ ਦੇ ਨਾਲ ਮੈਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਗਾ